ਹਾਂਜੀ ਸਾਡੇ ਪਿੰਡ ਦੇ ਵਿੱਚ ਹੀ ਇੱਕ ਭਜਨ ਮੰਡਲੀ ਹੈ ਉਹ ਜ਼ਿਆਦਾਤਰ ਅਖਾੜਿਆਂ ਦੇ ਵਿੱਚ ਜਾਂ ਜਾਂ ਫਿਰ ਕਿਸੇ ਨੇ ਧਾਰਮਿਕ ਪ੍ਰੋਗਰਾਮ ਕਰਨਾ ਹੁੰਦਾ ਹੈ ਤਾਂ ਉੱਥੇ ਇਕੱਠੇ ਹੁੰਦੇ ਆ ਅਤੇ ਆਪਣੇ ਧਾਰਮਿਕ ਗੀਤਾਂ ਦੇ ਜਰ ਜਰੀਏ ਜਿਹੜਾ ਆ ਉਹ ਲੋਕਾਂ ਦਾ ਮਨੋਰੰਜਨ ਕਰਦੇ ਆ ਅਤੇ ਜਿਹੜੇ ਸੰਗੀਤ ਯੰਤਰ ਉਹ ਵਰਤਦੇ ਹਨ ਔਰ ਉਹਨਾਂ ਦੇ ਵਿੱਚ ਢੋਲ ਸ਼ੈਣੇ ਹਰਮੋਨੀਅਮ ਜਿਹੜੇ ਆ ਉਹ ਮੁੱਖ ਹੁੰਦੇ ਆ ਜਿਹਨਾਂ ਨੂੰ ਵਰਤ ਕੇ ਉਹ ਗੀਤ ਗਾਉਂਦੇ ਆ ਅਤੇ ਲੋਕਾਂ ਦਾ ਮਨੋਰੰਜਨ ਕਰਦੇ ਆ